ਬਾਗਬਾਨੀ ਵਿੱਚ ਮੈਨੂੰ ਬਹੁਤ ਜ਼ਿਆਦਾ ਦਿਲਚਸਪੀ ਹੈ ਮੈਨੂੰ ਬਹੁਤ ਸਾਰੇ ਨਵੇਂ ਪੌਦੇ ਜਿਵੇਂ ਕਿ ਗੁਲਾਬ ਸੰਨ ਫਲਾਵਰ ਇਹ ਸਭ ਚੀਜ਼ਾਂ ਲਗਾਉਣੀਆਂ ਬਹੁਤ ਹੀ ਚੰਗੀਆਂ ਲੱਗਦੀਆਂ ਹਨ ਇਹ ਮੇਰੇ ਪਰਿਵਾਰ ਵਿੱਚ ਮੇਰੇ ਤੋਂ ਇਲਾਵਾ ਮੇਰੇ ਪਾਪਾ ਨੂੰ ਵੀ ਇਹ ਸਭ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਕ ਹੈ ਅਸੀਂ ਨਵੇਂ ਤੋਂ ਨਵੇਂ ਪੌਦੇ ਲਾਉਣ ਵਿੱਚ ਜ਼ਿਆਦਾ ਵਧੀਆ ਸਮਝਦੇ ਜ਼ਿਆਦਾ ਰੁਚੀ ਰੱਖਦੇ ਹਾਂ ਕਿਉਂਕਿ ਨਵੇਂ ਤੋਂ ਨਵੇਂ ਪੌਦੇ ਲਾਉਣ ਨਾਲ ਇੱਕ ਤਾਂ ਸਾਡਾ ਵਾਤਾਵਰਨ ਖੁਸ਼ਨੁਮਾ ਅਤੇ ਵਧੀਆ ਰਿਹਾ ਵਧੀਆ ਰਹਿੰਦਾ ਆ ਅਤੇ ਜਿਸ ਨਾਲ ਸਾਨੂੰ ਆਕਸੀਜਨ ਅਤੇ ਇਹ ਸਭ ਚੀਜ਼ਾਂ ਸਾਰੀ ਵਧੀਆ ਮਿਲਦੀਆਂ ਹਨ ਪੇੜ ਪੌਦੇ ਤਾਂ ਸਾਡੇ ਜੀਵਨ ਦਾ ਆਧਾਰ ਹੈ ਜੇਕਰ ਪੇੜ ਪੌਦੇ ਨਾ ਹੋਣਗੇ ਤਾਂ ਆਪਾਂ ਆਪਦੀ ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਨਹੀਂ ਕਰ ਸਕਦੇ ਚੰਗੀ ਤਰ੍ਹਾਂ ਬਤੀਤ ਇਸ ਲਈ ਨਹੀਂ ਕਰ ਸਕਦੇ ਕਿਉਂਕਿ ਆਕਸੀਜਨ ਦੇਣ ਦਾ ਕੰਮ ਪੇੜ ਪੌਦਿਆਂ ਤੋਂ ਹੈ ਮਿਲਦਾ ਹੈ ਪੇੜ ਪੌਦੇ ਨਾ ਹੀ ਇਕੱਲੀ ਆਕਸੀਜਨ ਬਲਕਿ ਖਾਣ ਪੀਣ ਨੂੰ ਆਪਾਂ ਨੂੰ ਬਹੁਤ ਸਾਰੀ ਦਵਾਈਆਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਪੇੜ ਪੌਦੇ ਕਾਰਗਰ ਸਾਬਤ ਹੁੰਦੇ ਆ ਮੇਰੇ ਪਰਿਵਾਰ ਵਿੱਚ ਮੇਰੇ ਪਾਪਾ ਨੂੰ ਵੀ ਇਹ ਸਭ ਚੀਜ਼ਾਂ ਦਾ ਬਹੁਤ ਸ਼ੌਕ ਆ ਅਸੀਂ ਬਹੁਤ ਜ਼ਿਆਦਾ ਪੌਦੇ ਪੇੜ ਪੌਦੇ ਲਗਾਉਣ ਦੇ ਵਿੱਚ ਰੁਚੀ ਰੱਖਦੇ ਹਾਂ ਅਸੀਂ ਦੋ ਚਾਰ ਦਿਨ ਪਹਿਲਾਂ ਹੀ ਪੰਜ ਗੁਲਾਬ ਦੇ ਪੌਦੇ ਅਤੇ ਚਾਰ ਤੁਲਸੀ ਦੇ ਪੌਦੇ ਨੇੜਲੇ ਪਾਰਕ ਵਿੱਚ ਲਾ ਕੇ ਆਏ ਹਾਂ ਇਹ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਦਿੰਦਾ ਕਿਉਂਕਿ ਇਹ ਵਾਲੀ ਚੀਜ਼ ਮੇਰੇ ਮੇਰੇ ਅੰਦਰ ਮੇਰੇ ਪਾਪਾ ਤੋਂ ਹੀ ਆਈ ਹੈ ਕਿਉਂਕਿ ਉਹਨਾਂ ਨੂੰ ਵੀ ਪੇੜ ਪੌਦਿਆਂ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਦਿਲਚਸਪੀ ਹੈ ਅਤੇ ਜਿਸ ਕਰਕੇ ਮੈਨੂੰ ਵੀ ਇਹ ਸਭ ਚੀਜ਼ਾਂ ਦੇਖਣਾ ਅਤੇ ਕਰਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਮੈਂ ਉਹਨੂੰ ਉਹਨਾਂ ਨੂੰ ਰੋਜ਼ ਪਾਣੀ ਦੇਣਾ ਅਤੇ ਉਹਨਾਂ ਉਹਨਾਂ ਦੇ ਮਤਲਬ ਇਹ ਦੇਖਣਾ ਕਿ ਉਹ ਸੁੱਕਣ ਨਾ ਅਤੇ ਉਹਨਾਂ ਦੀ ਸਾਰੀ ਜ਼ਰੂਰਤਾਂ ਪੂਰੀਆਂ ਕਰਨਾ ਬਹੁਤ ਵਧੀਆ ਲੱਗਦਾ ਪੇੜ ਵੀ ਆਪਣੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਹਨ ਕਿਉਂਕਿ ਉਹ ਆਪਾਂ ਨੂੰ ਸਾਰੀਆਂ ਚੀਜ਼ਾਂ ਹੀ ਦਿੰਦੇ ਹਨ ਅਤੇ ਇਸ ਕਰਕੇ ਆਪਾਂ ਨੂੰ ਪੇੜਾਂ ਨੂੰ ਸੰਭਾਲਣਾ ਚਾਹੀਦਾ ਅਤੇ ਇਸ ਕਰਕੇ ਮੇਰੇ ਪਾਪਾ ਅਤੇ ਮੈਂ ਇਹ ਚੀਜ਼ ਦੇਖਦੀ ਹਾਂ ਕਿ ਅਸੀਂ ਵੱਧ ਤੋਂ ਵੱਧ ਪੇੜ ਉਗਾਈਏ ਅਤੇ ਆਪਣੇ ਵਾਤਾਵਰਨ ਨੂੰ ਵਧੀਆ ਰੱਖੀਏ